ਮੈਂ ਖਾਲਸਾ ਕੋਲੇਜ ਵਿੱਚ ਅਸਿਸਟੈਂਟ ਪ੍ਰੋਫੈਸਰ ਹਾਂ ਇੱਥੇ ਸਾਨੂੰ ਪੰਜ ਘੰਟਿਆਂ ਦਾ ਵਰਕਲੋਡ ਹੈ ਸਾਡਾ ਖਾਲਸਾ ਕੋਲੇਜ ਦਾ ਟਾਈਮ ਅੱਠ ਘੰਟੇ ਹੈ ਬਟ ਇਹਦੇ ਨਾਲ ਸਾਨੂੰ ਹੋਰ ਐਕਟੀਵਿਟੀਆਂ ਜਿਵੇਂ ਯੂਥ ਐਕਟ ਯੂਥ ਫੈਸਟੀਵਲ ਦੀ ਐਕਟੀਵਿਟੀਜ਼ ਹੋ ਗਈਆਂ ਬੱਚਿਆਂ ਦੇ ਐੱਮ ਐੱਸ ਟੀਜ ਕਰਵਾਉਣੇ ਉਹਨਾਂ ਦੀ ਇੰਟਰਨਲ ਅਸੈਸਮੈਂਟ ਲਾਉਣੀ ਅਤੇ ਪ੍ਰੈਜਟੇਸ਼ਨਸ ਕਰਵਾਉਣੀਆਂ ਦੇਖੋ ਇਹ ਚੀਜ਼ਾਂ 'ਚ ਬ ਬਹੁਤ ਜ਼ਿਆਦਾ ਵਾਦ ਵਿਵਾਦ ਆਉਂਦੇ ਹਨ ਬਟ ਅਸੀਂ ਫੇਰ ਵੀ ਬੱਚਿਆਂ ਦੇ ਇਹ ਚੀਜ਼ਾਂ ਨੂੰ ਨਿਪਟਾਉਣ ਲਈ ਉਹਨਾਂ ਨਾਲ ਕੋਪਰੇਟ ਕਰਦੇ ਹਾਂ ਕਿਸੇ ਨੂੰ ਕ ਕੋਈ ਮੁਸ਼ਕਲ ਨਹੀਂ ਆਉਂਦੀ ਅਤੇ ਜਿਹੜਾ ਸਾਨੂੰ ਕੰਮ ਮਿਲਦਾ ਹੈ ਅਸੀਂ ਉਹ ਰੈਗੂਲਰ ਬੇਸਿਸ 'ਤੇ ਪੂਰਾ ਕਰਦੇ ਹਾਂ ਜੇ ਸਾਨੂੰ ਕੋਈ ਵਾਧੂ ਕਾਰਜ ਮਿਲਦਾ ਹੈ ਉਹਨੂੰ ਜਾ ਕੇ ਅਸੀਂ ਘਰ ਨਿਪਟਾ ਲੈਂਦੇ ਹਾਂ ਤਾਂ ਕਿ ਕੋਈ ਮੁਸ਼ਕਲ ਨਾ ਆਵੇ ਅਤੇ ਹੋਰ ਅਸੀਂ ਜਿਵੇਂ ਪ੍ਰੈਜਟੇਸ਼ਨਸ ਹੋ ਗਿਆ ਐੱਮ ਐੱਸ ਟੀਜ਼ ਉਹ ਅਸੀਂ ਕੰਮ ਵੀ ਅਸੀਂ ਥੋੜ੍ਹਾ ਮੋਟਾ ਘਰ ਜਾ ਕੇ ਪੂਰਾ ਕਰ ਲੈਂਦੇ ਹਾਂ